ਜੇਕਰ ਸਾਡੇ ਇਲਾਕੇ 'ਚ ਗੱਲ ਕਰੀਏ ਮਨਾਈਆਂ ਜਾਂਦੀਆਂ ਅਲੱਗ ਅਲੱਗ ਰਸਮਾਂ ਬਾਰੇ ਤਾਂ ਅਸੀਂ ਜ਼ਿਲ੍ਹਾ ਮੈਂ ਪਿੰਡ ਰੈਲ ਮਾਜਰਾ ਜ਼ਿਲ੍ਹਾ ਐੱਸ ਬੀ ਐੱਸ ਨਗਰ ਨਵਾਂਸ਼ਹਿਰ ਤੋਂ ਬਿਲੋਂਗ ਕਰਦੀ ਹਾਂ ਸਾਡੇ ਏਰੀਏ 'ਚ ਸਭ ਤੋਂ ਫੇਮਸ ਜਗ੍ਹਾ ਪੈਂਦੀ ਹੈ ਖਟਕੜ ਕਲਾਂ ਪਿੰਡ ਜੋ ਕਿ ਸ਼ਹੀਦ ਭਗਤ ਸਿੰਘ ਦਾ ਪਿੰਡ ਹੈ ਨ ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਵਰਸ ਮੇਲੇ ਵਤਨ ਪਰ ਮਿਟਨੇ ਵਾਲੋਂ ਕਾ ਬਾਕੀ ਜਿਹੀ ਨਿਸ਼ਾ ਹੋਗਾ ਇਸੇ ਤਰ੍ਹਾਂ ਹਰ ਸਾਲ ਉਹਨਾਂ ਸ਼ਹੀਦਾਂ ਦੀ ਸ਼ ਮਤਲਬ ਉਹਨਾਂ ਦੀ ਬਰਸੀ ਮਨਾਈ ਜਾਂਦੀ ਹੈ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਖੇ ਖੜਕਲ ਕਲਾਂ ਇੱਕ ਬਹੁਤ ਹੀ ਪ੍ਰਸਿੱਧ ਪਿੰਡ ਕਹਿ ਸਕਦੇ ਹਾਂ ਆਪਾਂ ਜਿੱਥੇ ਕਿ ਸ਼ਹੀਦ ਭਗਤ ਸਿੰਘ ਦਾ ਘਰ ਹੈ ਲੋਕ ਦੂਰੋਂ ਦੂਰੋਂ ਸੈਲਾਨੀ ਜਿਹੜੇ ਇਹਨਾਂ ਨੂੰ ਵੇਖਣ ਆਉਂਦੇ ਨੇ ਦੂਜੀ ਗੱਲ ਕਿ ਸਰਕਾਰ ਵੱਲੋਂ ਕੁਝ ਉਪਰਾਲੇ ਕਰਕੇ ਇੱਥੇ ਇੱਕ ਮਿਊਜ਼ੀਅਮ ਬਣਾਇਆ ਗਿਆ ਹੈ ਇਹ ਮਿਊਜ਼ੀਅਮ ਵਿੱਚ ਬਹੁਤ ਸਾਰੀਆਂ ਚੀਜ਼ਾਂ ਵਿਭਿੰਨ ਹਨ ਜੋ ਕਿ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਅਤੇ ਅਲੱਗ ਅਲੱਗ ਉਹਨਾਂ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਇੱਥੇ ਹਰ ਸਾਲ ਮਤਲਬ ਅਲੱਗ ਅਲੱਗ ਤਰ੍ਹਾਂ ਦੇ ਲੋਕ ਅਲੱਗ ਅਲੱਗ ਦੇਸ਼ਾਂ ਤੋਂ ਲੋਕ ਇਹਨਾਂ ਨੂੰ ਦੇਖਣ ਆਉਂਦੇ ਨੇ ਜਿਨ੍ਹਾਂ 'ਚ ਬਹੁਤ ਕੁਛ ਅਲੱਗ ਹੈ ਬਹੁਤ ਕੁਛ ਅਲੱਗ ਦੇਖਣ ਨੂੰ ਮਿਲਦਾ ਅਤੇ ਹਰ ਸਾਲ ਇਨ੍ਹਾਂ ਇਸ ਮਿਊਜ਼ੀਅਮ ਵਿੱਚ ਸ਼ਹੀਦਾਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾਂਦਾ ਹੈ ਜੇ ਇਹ ਮਿਊਜ਼ੀਅਮ ਦੀ ਗੱਲ ਕਰੀਏ ਤਾਂ ਇੱਕ ਮਨੋਰੰਜਨ ਦਾ ਸਾਧਨ ਵੀ ਹੈ ਅਤੇ ਆਪਣੇ ਏਰੀਏ 'ਚ ਹੋਰ ਗੱਲ ਕਰੀਏ ਤਾਂ ਸਾਨੂੰ ਸਾਡੇ ਨੇੜੇ ਗੁਰਦੁਆਰਾ ਸਾਹਿਬ ਪੈਂਦਾ ਜਿਹੜਾ ਕਿ ਕੋਟ ਹੈੱਡ ਦਰਬਾਰ ਪਰਾਣ ਹੈ ਇਹਨੂੰ ਟਿੱਬੀ ਸਾਹਿਬ ਵੀ ਬੋਲਿਆ ਜਾਂਦਾ ਉੱਥੇ ਬਹੁਤ ਸਾਰੀਆਂ ਸੰਗਤਾਂ ਦਰਸ਼ਨ ਕਰਨ ਨੂੰ ਆਉਂਦੀਆਂ ਨੇ ਅਤੇ ਇਹ ਗੁਰਦੁਆਰਾ ਸਤਲੁਜ ਦਰਿਆ ਦੇ ਕਿਨਾਰੇ 'ਤੇ ਸਥਿਤ ਹੈ ਜਿੱਥੇ ਕਿ ਬਹੁਤ ਸਾਰੇ ਸੈਲਾਨੀ ਹਰ ਸਾਲ ਇਹਨੂੰ ਦੇਖਣ ਨੂੰ ਆਉਂਦੇ ਨੇ ਅਤੇ ਇਹ ਬਹੁਤ ਹੀ ਸ਼ਾਂਤ ਜਗ੍ਹਾ ਹੈ ਮੈਂ ਜਦ ਵੀ ਉੱਥੇ ਜਾਂਦੀ ਹਾਂ ਤਾਂ ਮੇਰੇ ਦਿਲ ਨੂੰ ਬਹੁਤ ਹੀ ਸ਼ਾਂਤੀ ਮਿਲਦੀ ਹੈ